ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਠੀਕ ਠਾਕ ਮੈਂ ਤੁਹਾਡਾ ਕੈਬ ਡਰਾਈਵਰ ਬੋਲ ਰਿਹਾ ਜੀ ਤੁਸੀਂ ਕੈਬ ਬੁੱਕ ਕੀਤੀ ਸੀ ਨਾ ਹਾਂਜੀ ਕਿੱਥੋਂ ਦੀ ਕਿੱਥੋਂ ਕੀਤੀ ਸੀ ਮੈਂ ਲੁਹਾਰਕਾ ਰੋਡ ਤੋਂ ਬੋਲ ਰਿਹਾ ਚੁੰਘੀ ਵਾਲਾ ਬਜ਼ਾਰ ਕਿੱਥੇ

ਚਲੋ ਠੀਕ ਹੈ ਫਿਰ ਵੀ ਤੁਸੀਂ ਲੋਕੇਸ਼ਨ ਵੀ ਭੇਜ ਦਿਓ ਆਪਣੀ ਹਾਂਜੀ ਉਹ ਸਮਝ ਨਹੀਂ ਆ ਰਹੀ ਹਾਂਜੀ ਲੋਕੇਸ਼ਨ ਭੇਜੋ ਆਪਣੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ